ਏ ਟੀ ਐੱਮ ਤੋਂ ਪੈਸੇ ਕੱਢਵਾਉਣ ਦੇ ਲਈ ਸਭ ਤੋਂ ਪਹਿਲਾਂ ਏ ਟੀ ਐੱਮ ਮਸ਼ੀਨ ਤੱਕ ਜਾਣਾ ਪਵੇਗਾ ਅਤੇ ਏ ਟੀ ਐੱਮ ਮਸ਼ੀਨ 'ਤੇ ਜਾ ਕੇ ਜੋ ਸਾਡਾ ਏ ਟੀ ਐੱਮ ਹੈ ਉਸ ਨੂੰ ਜਿਹੜੀ ਏ ਟੀ ਐੱਮ ਮਸ਼ੀਨ ਹੈ ਉਸ ਦੇ ਨਾਲ਼ ਸਕੈਨ ਕੀਤਾ ਜਾਵੇਗਾ ਸਕੈਨ ਕਰਨ ਤੋਂ ਬਾਅਦ ਉੱਥੇ ਮਸ਼ੀਨ ਦੇ ਉੱਤੇ ਸਾਰੀ ਇੰਨਫ਼ੋਮੇਸ਼ਨ ਆ ਜਾਵੇਗੀ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਕਿ ਤੁਸੀਂ ਕਿਹੜੀ ਭਾਸ਼ਾ ਚੁਣਨੀ ਹੈ ਭਾਸ਼ਾ ਚੁਣਨ ਤੋਂ ਬਾਅਦ ਤੁਸੀਂ ਆਪਣਾ ਉੱਥੇ ਪਿੰਨ ਜੋ ਤੁਹਾਡੇ ਏ ਟੀ ਐੱਮ ਦਾ ਪਿੰਨ ਹੈ ਉਹ ਤੁਸੀਂ ਉੱਥੇ ਭਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਕਿੰਨੇ ਪੈਸੇ ਕਢਵਾਉਣੇ ਹਨ ਉਸਦੀ ਅਮਾਊਂਟ ਤੁਸੀਂ ਏ ਟੀ ਐੱਮ 'ਤੇ ਭਰ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਤੁਹਾਡਾ ਖਾਤਾ ਏ ਤੁਸੀਂ ਸੇਵਿੰਗ 'ਚੋਂ ਕਢਵਾਉਣੇ ਆ ਜਾਂ ਵਿਦਡਰੋਲ ਕਰਵਾਉਣੇ ਹੈ ਉਹ ਸਾਰੀਆਂ ਆਪਸ਼ਨਜ ਉੱਪਰ ਆ ਜਾਣਗੀਆਂ ਉਹ ਸਾਰੀਆਂ ਸਲੈਕਟ ਕਰਕੇ ਤੁਸੀਂ ਉੱਥੇ ਆਪਣੇ ਪੈਸੇ ਕੱਢਵਾ ਸਕਦੇ ਹੋ ਅਸਾਨੀ ਨਾਲ਼